ਮੈਂ ਇੱਕ ਬਾਈਕਿੰਗ ਦੇ ਰੇਸ ਸਮਾਗਮ ਵਿੱਚ ਹਿੱਸਾ ਲਿਆ ਸੀ ਅੱਜ ਮੈਂ ਉਸਦੇ ਅਨੁਭਵ ਜ਼ਾਹਰ ਕਰਨਾ ਚਾਹਾਂਗਾ ਬਾਈਕਿੰਗ ਦੇ ਨਾਲ ਮੇਰੇ ਤਜ਼ਰਬਿਆਂ ਉੱਤੇ ਵਿਚਾਰ ਕਰਦਿਆਂ ਮੈਨੂੰ ਅਹਿਸਾਸ ਹੋਇਆ ਹੈ ਕਿ ਇਸ ਨੇ ਮੈਨੂੰ ਜ਼ਿੰਦਗੀ ਦੇ ਕੀਮਤੀ ਸਬਕ ਸਿਖਾਏ ਹਨ ਜੋ ਮੈਂ ਵੱਖ ਵੱਖ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਉੱਤੇ ਲਾਗੂ ਕਰ ਸਕਦਾ ਹਾਂ ਅਨੁਸ਼ਾਸਨ ਅਤੇ ਤੰਦਰੁਸਤੀ ਤੋਂ ਲੈ ਕੇ ਦੋਸਤੀ ਅਤੇ ਮਦਦਗਾਰਤਾ ਤੱਕ ਬਾਈਕਿੰਗ ਨੇ ਮੈਨੂੰ ਉਦੇਸ਼ ਅਤੇ ਨਿੱਜੀ ਵਿਕਾਸ ਦੀ ਭਾਵਨਾ ਦਿੱਤੀ ਹੈ ਇਸਨੇ ਮੈਨੂੰ ਦਿਆਵਾਨ ਅਤੇ ਹਮਦਰਦੀ ਰੱਖਣਾ ਛੋਟੀਆਂ ਚੀਜ਼ਾਂ ਦੀ ਕਦਰ ਕਰਨਾ ਅਤੇ ਸੰਤੁਲਨ ਅਤੇ ਸਦਭਾਵਨਾ ਲਈ ਯਤਨ ਕਰਨਾ ਵੀ ਸਿਖਾਇਆ ਹੈ ਬਾਈਕਿੰਗ ਰਾਹੀਂ ਮੈਂ ਟੀਚੇ ਨਿਰਧਾਰਤ ਕਰਨਾ ਸਿੱਖ ਲਿਆ ਹੈ ਪ੍ਰਗਤੀ ਨੂੰ ਟਰੈਕ ਕਰਨਾ ਅਨੁਕੂਲਤਾ ਦਾ ਵੀ ਵਿਕਾਸ ਹੋਇਆ ਹੈ ਮੈਂ ਸਬਰ ਸਵੈ ਅਨੁਸ਼ਾਸਨ ਦੀ ਮਹੱਤਤਾ ਨੂੰ ਵੀ ਮਹਿਸੂਸ ਕੀਤਾ ਹੈ ਇਸ ਤੋਂ ਇਲਾਵਾ ਬਾਈਕਿੰਗ ਨੇ ਮੇਰੇ ਅੰਦਰ ਬਹੁਤ ਸਾਰੇ ਲਾਭ ਪ੍ਰਦਾਨ ਕੀਤੇ ਹਨ ਜਿਵੇਂ ਕਿ ਬਾਈਕਿੰਗ ਨੇ ਮੈਨੂੰ ਸਵੈ ਸੁਧਾਰ ਦੇ ਰਾਹ ਉੱਤੇ ਪਾ ਦਿੱਤਾ ਹੈ ਮੈਨੂੰ ਬਾਹਰੀ ਤੁਲਨਾਵਾਂ ਵਿੱਚ ਫਸਣ ਦੀ ਬਜਾਏ ਹੁਣ ਆਪਣੀ ਸਮਰੱਥਾ ਦੇ ਵਿਰੁੱਧ ਦੌੜਨਾ ਸਿਖਾ ਦਿੱਤਾ ਹੈ ਹਰ ਸਵਾਰੀ ਆਪਣੇ ਆਪ ਨੂੰ ਬਿਹਤਰ ਬਣਾਉਣ ਵੱਲ ਇੱਕ ਯਾਤਰਾ ਹੈ ਅਤੇ ਮੈਂ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਲਗਾਤਾਰ ਨਵੇਂ ਨਿੱਜੀ ਮੀਲ ਪੱਥਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ